ਅਗਰ ਮੈਨੂੰ ਕਿਸਾਨਾਂ ਦੀ ਮਦਦ ਕਰਨ ਲਈ ਮੌਕਾ ਮਿਲਦਾ ਤਾਂ ਸਭ ਤੋਂ ਪਹਿਲਾਂ ਮੈਂ ਜੋ ਐੱਮ ਐੱਸ ਪੀ ਬਾਰੇ ਬਹੁਤ ਟਾਈਮ ਤੋਂ ਸੰਘ ਕਿਸਾਨ ਸੰਘਰਸ਼ ਕਰ ਰਹੇ ਆ ਉਸਨੂੰ ਲਾਗੂ ਕਰਾਂਗਾ ਉਸ ਤੋਂ ਬਾਅਦ ਜੋ ਮਜ਼ਦੂਰ ਆਪਣਾ ਕੰਮ ਕਰਦੇ ਹੈ ਉਹਨਾਂ ਨੂੰ ਟਾਈਮ ਨਾਲ ਮਜ਼ਦੂਰੀ ਸਹੀ ਰੇਟ ਦੇ ਨਾਲ ਮਿਲਦੀ ਰਹੇ ਤਾਂ ਕਿ ਆਪਣਾ ਘਰ ਦਾ ਖਰਚਾ ਸਹੀ ਤਰੀਕੇ ਨਾਲ ਚਲਾ ਸਕਣ ਔਰ ਜੋ ਵੀ ਕਿਸਾਨ ਜਿੰਨੀ ਵੀ ਖੇਤੀ ਕਰਦੇ ਆ ਔਰ ਜਿੰਨਾ ਉਹਨਾਂ ਦਾ ਬਿਜਾਈ ਤੋਂ ਲੈ ਕੇ ਮਿਹਨਤ ਤੱਕ ਜਿੰਨਾ ਵੀ ਮੁੱਲ ਆ ਉਹਨਾਂ ਨੂੰ ਦੇਣ ਦੀ ਕੋਸ਼ਿਸ਼ ਕੀਤੀ ਜਾਵੇਗੀ ਔਰ ਡਾਇਰੈਕਟ ਕੋਈ ਵੀ ਕਿਸਾਨ ਦੀ ਫ਼ਸਲ ਆ ਉਹਨੂੰ ਸਰਕਾਰ ਦੇ ਹਵਾਲੇ ਕੀਤਾ ਜਾਵੇ ਤਾਂ ਕਿ ਆੜ੍ਹਤੀਆਂ ਦੇ ਚੱਕਰ ਨਾ ਲਾਉਣੇ ਪੈਣ ਆੜ੍ਹਤੀਆਂ ਕੋਲ ਖੱਜਲ ਖੁਆਰੀ ਨਾ ਹੋਵੇ ਕਈ ਕਈ ਦਿਨ ਕਈ ਕਈ ਮਹੀਨੇ ਆਪਣੇ ਕੋਲ ਰੱਖ ਕੇ ਬੈਠਦੇ ਹਨ ਉਸ ਤੋਂ ਬਚਾ ਬਚਾਉਣ ਦੀ ਕੋਸ਼ਿਸ਼ ਕਰਾਂਗੇ